ਸਤਿ ਸ਼੍ਰੀ ਅਕਾਲ ਸਰ ਮੈਂ ਤੁਹਾਡੀ ਕੰਪਨੀ ਤੋਂ ਨਾ ਇੱਕ ਕੈਬ ਬੁੱਕ ਕੀਤੀ ਸੀਗੀ ਚੰਡੀਗੜ੍ਹ ਖੰਨਾ ਟੂ ਚੰਡੀਗੜ੍ਹ ਜਾਣ ਲਈ ਠੀਕ ਹੈ ਸਰ ਉਹ ਮੈਂ ਕੈਬ ਤਿੰਨ ਤਰੀਕ ਨੂੰ ਬੁੱਕ ਕੀਤੀ ਸੀਗੀ ਅਤੇ ਅਸੀਂ ਪੰਦਰ੍ਹਾਂ ਤਰੀਕ ਨੂੰ ਦਿੱਲੀ ਜਾਣਾ ਸੀਗਾ ਅਤੇ ਉਹ ਸਰ ਮੇਰੇ ਘਰ ਕੋਈ ਪ੍ਰੋਬਲਮ ਹੋ ਗਈ ਨਾ ਮੇਰੇ ਦਾਦਾ ਜੀ ਨੂੰ ਹਾਰਟ ਅਟੈਕ ਆ ਗਿਆ ਰਾਤ ਫਿਰ ਅਸੀਂ ਉਹਨਾਂ ਨੂੰ ਖੰਨੇ ਲੈ ਕੇ ਗਏ ਖੰਨੇ ਟੂ ਅਸੀਂ ਪੀ ਜੀ ਆਈ ਲੈ ਕੇ ਗਏ ਪੀ ਜੀ ਆਈ ਤੋਂ ਸਰ ਉਹ ਮਤਲਬ ਉਹਨਾਂ ਦੀ ਡੈਥ ਹੋ ਗਈ ਇਸ ਕਰਕੇ ਸਰ ਅਸੀਂ ਤੁਹਾਡੀ ਕੈਬ ਆ ਜਿਹੜੀ ਉਹ ਅਸੀਂ ਨਹੀਂ ਲੈ ਸਕਦੇ ਸੀ ਸਾਡਾ ਦਿੱਲੀ ਵਾਲਾ ਪ੍ਰੋਗਰਾਮ ਆ ਜਿਹੜਾ ਉਹ ਨਾ ਉਹ ਕੈਂਸਲ ਹੋ ਗਿਆ ਇਸ ਲਈ ਸਰ ਸਾਨੂੰ ਜਿਹੜੇ ਅਸੀਂ ਵੀ ਜਿਹੜੀ ਅਡਵਾਂਸ ਪੇਮੈਂਟ ਕੀਤੀ ਆ ਤੁਹਾਡੇ ਕੋਲ ਉਹ ਸਾਨੂੰ ਵਾਪਸ ਕਰ ਸਕਦੇ ਹੋ ਅਤੇ ਸਾਡੀ ਉਹ ਵਾਪਸ ਕਰ ਸਕਦੇ ਹੋ ਸਰ ਉਹਦਾ ਕਾਰ ਦਾ ਨੰਬਰ ਸੀਗਾ ਥ੍ਰੀ ਏਟ ਨਾਈਨ ਫੋਰ ਥ੍ਰੀ ਸੈਵਨ ਸਿਕਸ ਥ੍ਰੀ ਥ੍ਰੀ ਏਟ ਠੀਕ ਹੈ ਸਰ ਇਹ ਕਾਰ ਦਾ ਨੰਬਰ ਸੀਗਾ ਅਤੇ ਅਲਟੋ ਕਾਰ ਸੀਗੀ ਸਰ ਅਸੀਂ ਅਸੀਂ ਫਾਈ ਅਸੀਂ ਫਾਈਵ ਫੈਮਿਲੀ ਮੈਂਬਰ ਨੇ ਉੱਥੇ ਨਾਲ ਜਾਣਾ ਸੀ ਸਰ ਇਸ ਲਈ ਜਿਹੜੀ ਸਾਡੀ ਅਡਵਾਂਸ ਪੇਮੈਂਟ ਆ ਉਹ ਕਿੱਥੋਂ ਸਾਨੂੰ ਅਸੀਂ ਜੀ ਪੇ ਜਾਂ ਗੂਗਲ ਪੇ ਯੂਜ਼ ਨਹੀਂ ਕਰਦੇ ਅਤੇ ਸਾਨੂੰ ਸਾਡੇ ਬੈਂਕ ਖਾਤੇ ਰਾਹੀਂ ਤੁਸੀਂ ਜਿਹੜੀ ਟ੍ਰਾਂਸਫਰ ਟਰਾਂਸਫਰ ਕੀਤੀ ਸੀ ਅਸੀਂ ਮਨੀ ਤੁਹਾਨੂੰ ਉਹ ਸਾਨੂੰ ਦੇ ਸਕਦੇ ਹੋ ਅਤੇ ਸਾਡੇ ਅਕਾਊਂਟ ਨੰਬਰ ਹੈਗਾ ਜੀ ਥ੍ਰੀ ਥ੍ਰੀ ਸੈਵਨ ਏਟ ਸੈਵਨ ਥ੍ਰੀ ਨਾਈਨ ਵੰਨ ਜ਼ੀਰੋ ਥ੍ਰੀ ਫੋਰ ਥ੍ਰੀ ਏਟ ਨਾਈਨ ਇਹ ਸਾਡਾ ਅਕਾਊਂਟ ਨੰਬਰ ਹੈ ਜੀ